ਵਾਰ ਐਂਡ ਫੇਸ ਲਿਓ ਟਾਸਰੇ ਵੈਟਸ ਲੈਂਡ ਪੀ ਐੱਸ ਈਲਾਈਟ ਟਾਈਮ ਮਸ਼ੀਨ ਐਚ ਜੀ ਵੈਲਸ ਪੋਲੀਟਿਕਸ ਐਰਿਜ ਟੋਟਲ ਪੈਰਾਡਾਈਜ਼ ਲੋਟਸ ਜੋਨ ਮਿਲਟਨ ਦ ਰੂਮ ਔਫ ਦਾ ਰੂਟਸ ਰਿਸਕ ਐਂਡ ਬੌਂਟ